ਹੈਲੋ ਸਤਿ ਸ਼੍ਰੀ ਅਕਾਲ ਭਾਜੀ ਭਾਅ ਜੀ ਤੁਸੀਂ ਸਾਹੀਲ ਬੋਲ ਰਹੇ ਹੋ ਤੁਸੀਂ ਭਾਅ ਜੀ ਮੈਂ ਨਾ ਤੁਹਾਡੇ ਕੋਲ ਪਰਸੋਂ ਚੌਥ ਨਾ ਇੱਕ ਜੁੱਤੇ ਲੈ ਕੇ ਗਿਆ ਸੀ ਐਡੀਡਾਸ ਏਅਰ ਦੇ ਹਾਂਜੀ ਭਾਅ ਜੀ ਨੌ ਸਾਈਜ਼ ਜੀ ਮੇਰਾ ਹਾਂਜੀ ਭਾਅ ਜੀ ਦਿੱਕਤ ਇਹ ਹੈਗੀ ਕਿ ਉਹਦਾ ਜਿਹੜਾ ਰੰਗ ਹੈ ਨਾ ਉਹ ਉੱਡ ਗਿਆ ਉਹ ਕਿਉਂਕਿ ਉਹਨੂੰ ਮੈਂ ਧੋਤਾ ਧੁਤਾ ਅਤੇ ਉਹਦੇ ਰੰਗ ਰੁੰਗ ਉੱਡ ਗਏ ਭਾਅ ਜੀ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੋਈ ਹੈ ਨਹੀਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਗੱਲ ਕੀ ਹੋਈ ਅਸਲ 'ਚ ਇਹ ਮੈਂ ਵਿਆਹ ਗਿਆ ਸੀ ਅਤੇ ਵਿਆਹ ਤੋਂ ਬਾਅਦ ਨਾ ਗੰਦੇ ਗੁੰਦੇ ਹੋ ਗਏ ਥੋੜ੍ਹੇ ਤੁਹਾਨੂੰ ਪਤਾ ਹੀ ਹੈ ਹੁਣ ਬੰਦਾ ਵਿਆਹ ਵਿਹੁਅ ਜਾਂਦਾ ਅਤੇ ਬੂਟ ਹੋ ਹੀ ਜਾਂਦੇ ਗੰਦੇ ਤੇ ਤੇ ਗੱਲ ਇਹ ਹੋਈ ਕਿ ਮੈਂ ਧੋ ਧੂ ਦਿੱਤੇ ਅਤੇ ਮੈ ਇਹਨੂੰ ਚੰਗੀ ਤਰ੍ਹਾਂ ਨਾ ਅਤੇ ਧੁੱਪੇ ਰੱਖ ਦਿੱਤੇ ਅਤੇ ਇਹਦੇ ਨਾ ਰੰਗ ਰੁੰਗ ਉੱਡ ਗਏ ਚਿੱਟੇ ਰੰਗ ਹੋ ਗਏ ਬਿਲਕੁਲ ਲਾਲ ਅਤੇ ਕਾਲਾ ਰੰਗ ਸੀ ਨਾ ਉਹਦਾ ਜਿਹੜਾ ਤੁਹਾਡੇ ਕੋਲੋਂ ਲੈ ਕੇ ਗਿਆ ਸੀ ਮੈਂ ਉਹਦੇ ਰੰਗ ਉੱਡ ਗਏ ਅਤੇ ਉਹ ਸਾਈਡ ਤੋਂ ਫਟ ਵੀ ਗਏ ਅਤੇ ਹੁਣ ਮੈਂ ਹੁਣ ਮੈਂ ਇੰਨਾ ਹੈਰਾਨ ਰਹਿ ਗਿਆ ਕਿ ਤੁਸੀਂ ਮੈਨੂੰ ਇੰਨੀ ਮਾੜੀ ਕੁਆਲਿਟੀ ਦਿੱਤੀ ਤੁਸੀਂ ਮੈਨੂੰ ਬਈ ਇਹ ਮੈਨੂੰ ਨਕਲੀ ਲੱਗ ਰਿਹਾ ਹੈ ਹਾਂਜੀ ਭਾਅ ਜੀ ਮੈਂ ਜਿਸ ਟਾਈਮ ਧੋਤੇ ਉਸ ਟਾਈਮ ਬਿਲਕੁਲ ਐਨ ਵਧੀਆ ਕੁਆਲਿਟੀ 'ਚ ਕੰਡੀਸ਼ਨ 'ਚ ਸੀਗਾ ਅਤੇ ਧੁੱਪੇ ਰੱਖੇ ਤਾਂ ਫਟ ਗਏ ਹੁਣ ਇਹ ਤਾਂ ਤੁਹਾਨੂੰ ਪਤਾ ਤੁਸੀਂ ਮੈਨੂੰ ਕਿੱਦਾਂ ਦੀ ਕੁਆਲਿਟੀ ਭੇਜੀ ਹੈ ਅੱਛਾ ਅਤੇ ਮੈਨੂੰ ਰੰਗ ਉਹੀ ਮਿਲ ਜਾਵੇਗਾ ਨਾ ਕਾਲਾ ਅਤੇ ਲਾਲ ਨੌ ਕਿਹਾ ਸੀ ਨੌ ਨਹੀਂ ਅਤੇ ਭਾਅ ਜੀ ਮੈਂ ਇੱਕ ਮੈਂ ਇਹਦਾ ਔਫਰ ਚੈੱਕ ਕੀਤਾ ਸੀ ਔਨਲਾਈਨ ਅਤੇ ਉਹ 'ਤੇ ਇਹਦੇ ਨਾਲ ਮੈਨੂੰ ਉਹ ਮਤਲਬ ਜਿੱਦਾਂ ਗਿਫਟ ਵੀ ਮਿਲਦੇ ਨਾ ਤੁਸੀਂ ਮੈਨੂੰ ਉਹ ਵੀ ਨਹੀਂ ਦਿੱਤੇ ਯਾਰ ਇਹ ਤਾਂ ਗੱਲ ਮਾੜੀ ਹੈ ਨਾ ਫਿਰ ਯਾਰ ਭਾਅ ਜੀ ਔਫਰ ਕਾਹਦਾ ਭਾਜੀ ਤੁਸੀਂ ਮੈਨੂੰ ਓਵਰਪ੍ਰਾਈਜ਼ ਕੀਤਾ ਹੈ ਨੈੱਟ 'ਤੇ ਮੈਂ ਦੇਖਿਆ ਕਿ ਇਹਦਾ ਪ੍ਰਾਈਜ ਜ਼ਿਆਦਾ ਹੈ ਮਤਲਬ ਸਸਤਾ ਹੈ ਅਤੇ ਤੁਸੀਂ ਮੈਨੂੰ ਜ਼ਿਆਦਾ ਲਾ ਰਹੇ ਹੋ ਯਾਰ ਅਤੇ ਵੀ ਤੁਸੀਂ ਮੈਨੂੰ ਕਹਿ ਰਹੇ ਕਿ ਮੈਂ ਤੁਹਾਨੂੰ ਔਫਰ ਦਿੱਤਾ ਹੈ ਅਤੇ ਉਹਦੇ ਨਾਲ ਗਿਫਟ ਵੀ ਮਿਲ ਰਿਹਾ ਪ੍ਰਾਈਜ ਘੱਟ ਹੈ ਫਿਰ ਏਦ ਇੱਦਾਂ ਨਾ ਨਾ ਕਰੋ ਤੁਸੀਂ ਭਾਅ ਜੀ ਤੁਸੀਂ ਇਹ ਐਦਾਂ ਔਨਲਾਈਨ ਪੈ ਰਹੇ ਅਠਾਰਾਂ ਸੌ ਰੁਪਏ ਦੇ ਹਾਂਜੀ ਹਾਂਜੀ ਹਾਂਜੀ ਤੁਸੀਂ ਸਾਨੂੰ ਦਿੱਤੇ ਤਿੰਨ ਹਜ਼ਾਰ ਦੇ ਚਲੋ ਠੀਕ ਹੈ ਕਿੰਨੇ ਵਜੇ ਆਈਏ ਕਿੰਨੇ ਵਜੇ ਆਈਏ ਤ ਤੁਹਾਡੇ ਕੋਲ ਫਿਰ ਕੱਲ੍ਹ ਜਾਂ ਪਰਸੋਂ ਠੀਕ ਹੈ ਭਾਅ ਜੀ ਠੀਕ ਆ ਓਕੇ ਭਾਅ ਜੀ ਧੰਨਵਾਦ